ਅੱਜ ਅਸੀਂ ਵਿਗਿਆਨ ਅਤੇ ਤਕਨੀਕੀ ਪੱਧਰ 'ਤੇ ਉਸ ਹੋਂਦ ਤੱਕ ਮੱਲਾਂ ਮਾਰੀਆਂ ਹਨ ਜਿਸ ਦੀ ਕਲਪਨਾ ਸਾਡੇ ਵੱਡੇ ਵਡੇਰਿਆਂ ਨੇ ਕਦੀ ਸਪਨੇ ਵਿੱਚ ਵੀ ਨਹੀਂ ਕੀਤੀ ਹੋਵੇਗੀ ਉੱਚ ਪੱਧਰ ਦੀ ਕੰਪਿਊਟਰਾਈਜ ਪੜ੍ਹਾਈ ਤਜਰਬੇਕਾਰ ਪ੍ਰੋਫੈਸਰ ਅਤੇ ਹੋਰ ਜ਼ਿੰਦਗੀ ਵਿੱਚ ਹਰ ਸੱਚ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਸਪਸ਼ਟ ਰੂਪ ਨਾਲ ਇਸ ਤਰ੍ਹਾਂ ਪੇਸ਼ ਕਰਨ ਵਿੱਚ ਸਮਰਥ ਹਨ ਜਿਸ ਨੂੰ ਕਦੀ ਝੁ ਝੁਠਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਉਸ ਬਾਰੇ ਕੋਈ ਦੋਰਾਵਾਂ ਹੀ ਹਨ ਆਖਿਆ ਜਾ ਸਕਦਾ ਹੈ ਕਿ ਸ਼ਾਇਦ ਹੀ ਕੁਛ ਅਜਿਹਾ ਰਹਿ ਗਿਆ ਹੋਵੇ ਜਿਸ ਦਾ ਹੱਲ ਨਾ ਹੋਵੇ ਕਿਉਂਕਿ ਸਾਇੰਸ ਦੀ ਖਾਸੀਅਤ ਅਨੁਸਾਰ ਇਸ ਦੀ ਹਰ ਚੀਜ਼ ਵਿੱਚ ਬਦਲਾਵ ਕਰ ਦਿੱਤਾ ਗਿਆ ਹੈ ਜਿਸ ਦਾ ਸੁਧਰਿਆ ਰੂਪ ਅਸੀਂ ਆਮ ਜ਼ਿੰਦਗੀ ਵਿੱਚ ਮਹਿਸੂਸ ਕਰ ਸਕਦੇ ਹਾਂ ਅਤੇ ਕਰ ਵੀ ਰਹੇ ਹਾਂ ਪਰ ਇੰਨਾ ਕੁਛ ਹੁੰਦਿਆਂ ਹੋਇਆਂ ਵੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਬਦਲਾਵ ਅਜੇ ਤੱਕ ਨਹੀਂ ਹੋ ਸਕਿਆ ਉਹ ਹੈ ਸਦੀਆਂ ਤੋਂ ਚੱਲਿਆ ਆ ਰਿਹਾ ਅੰਧ ਵਿਸ਼ਵਾਸ ਅਤੇ ਜਿਹਨੂੰ ਆਪਾਂ ਵਹਿਮ ਭਰਮ ਵੀ ਕਹਿੰਦੇ ਹਾਂ ਆ ਵਿਗਿਆਨਿਕ ਯੁੱਗ ਵਿੱਚ ਚਾਹੇ ਮਨੁੱਖ ਅੱਜ ਹਰ ਖੇਤਰ ਵਿੱਚ ਮੱਲਾ ਮਾਰ ਰਿਹਾ ਪਰ ਅੱਜ ਵੀ ਉਹ ਆਪਣੇ ਆਪ ਨੂੰ ਅੰਧ ਵਿਸ਼ਵਾਸ ਅਤੇ ਵਹਿਮ ਭਰਮਾਂ ਵਿੱਚੋਂ ਬਾਹਰ ਨਹੀਂ ਕੱਢ ਸਕਿਆ ਵਿਆਹ ਹੋ ਗਏ ਚਾਹੇ ਕੋਈ ਹੋਰ ਕੰਮ ਹੋਵੇ ਅੱਜ ਵੀ ਮਹੂਰਤ ਦੇਖ ਕੇ ਬਿਨਾਂ ਨਹੀਂ ਕੀਤਾ ਜਾਂਦਾ ਭਾਵੇਂ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਸਾਡੇ ਸਮਾਜ ਵਿੱਚ ਅਗਾਂਹਵਧੂ ਲੋਕ ਵੀ ਬਹੁਤ ਹਨ ਜੋ ਅੰਧ ਵਿਸ਼ਵਾਸ ਅਤੇ ਵਹਿਮ ਭਰਮਾਂ ਨੂੰ ਬਹੁਤ ਪੜਾਵਾ ਦਿੰਦੇ ਹਨ ਪਰ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਚੰਗੇ ਪੜ੍ਹੇ ਲਿਖਿਆਂ ਦੀ ਜਿਹੜੇ ਅੰਧ ਵਿਸ਼ਵਾਸ ਵਹਿਮ ਭਰਮਾਂ ਵਿੱਚ ਯਕੀਨ ਨਹੀਂ ਕਰਦੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੀ ਘੱਟ ਗਈ ਹੈ ਸਾਡੇ ਸਮਾਜ ਵਿੱਚ ਸਦੀਆਂ ਤੋਂ ਹੀ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਉਵੇਂ ਦਾ ਉਵੇਂ ਹੀ ਚੱਲਦਾ ਆ ਰਿਹਾ ਹੈ ਜਿਵੇਂ ਵੀਰਵਾਰ ਨੂੰ ਕੱਪੜੇ ਧੋਣ ਨਾਲ ਘਰ ਵਿੱਚ ਕਲੇਸ਼ ਵਧਣ ਦਾ ਕਰਨ ਮੰਨਿਆ ਜਾਂਦਾ ਹੈ ਸ਼ਨੀਚਰਵਾਰ ਜਾਂ ਮੰਗਲਵਾਰ ਨੂੰ ਹੱਥਾਂ ਦੇ ਨਹੁੰ ਕੱਟਣਾ ਖਾਲੀ ਕੈਂਚੀ ਨੂੰ ਚਲਾਉਣਾ ਮੰਗਲਵਾਰ ਨੂੰ ਵਾਲਾਂ ਦਾ ਕੱਟਣਾ ਸ਼ਨੀਚਰਵਾਰ ਨੂੰ ਲੋਹਾ ਖਰੀਦਣਾ ਜਾਂ ਵੇਚਣਾ ਮਾੜਾ ਸਮਝਿਆ ਜਾਂਦਾ ਹੈ ਸ਼ਨੀਚਰਵਾਰ ਨੂੰ ਤੇਲ ਦਾਨ ਕਰਨਾ ਚੰਗਾ ਸਮਝਿਆ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਹਿਮ ਭਰਮ ਮੰਨੇ ਜਾਂਦੇ ਹਨ ਜਿਵੇਂ ਕਿਸੇ ਸ਼ਹਿਰ ਗਰਾਂ ਜਾਂਦਿਆਂ ਨੂੰ ਖਾਲੀ ਬੱਠਲ ਵਾਲੀ ਔਰਤ ਦਾ ਮਿਲਣਾ ਜਾਂ ਘਰੋਂ ਨਿਕਲਦਿਆਂ ਹੀ ਕਿਸੇ ਨੀਵੀਂ ਜਾਤੀ ਦੀ ਔਰਤ ਜਾਂ ਮਰਦ ਦਾ ਮੱਥੇ ਲੱਗਣਾ ਬਿੱਲੀ ਦਾ ਰਸਤਾ ਕੱਟਣਾ ਕਾਲੇ ਕੁੱਤੇ ਦਾ ਰੋਣਾ ਹਥੇਲੀ 'ਤੇ ਖੁਰਕ ਹੋਣਾ ਇੱਕੋ ਸਮੇਂ ਦੋ ਜਣਿਆਂ ਦਾ ਇਕੱਠਾ ਬੋਲਣਾ ਪੈਰ ਹਿਲਾਉਣਾ ਬਿੱਲੀ ਜਾਂ ਬਿੱਲੀ ਦੇ ਰੋਣ ਦੀ ਆਵਾਜ਼ ਜਾਂ ਉਹਦਾ ਰਸਤਾ ਕੱਟਣਾ ਇਹ ਸਭ ਕੁਝ ਕੀ ਆ ਅਸ਼ੁੱਭ ਮੰਨਿਆ ਜਾਂਦਾ ਹੈ ਭਾਵੇਂ ਕਿ ਇਹਨਾਂ ਵਿੱਚੋਂ ਕੁਛ ਕੁ ਵਿਗਿਆਨੀ ਕਾਰਨ ਹਨ ਪਰ ਜ਼ਿਆਦਾਤਰ ਸਿਰਫ ਤੋਂ ਸਿਰਫ ਅੰਧ ਵਿਸ਼ਵਾਸ ਹੈ ਹੋਰ ਕੁਛ ਨਹੀਂ ਹੈ ਦੁਨੀਆਂ 'ਤੇ ਹਰ ਇੱਕ ਚੀਜ਼ ਦਾ ਇਲਾਜ ਆ ਪਰ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਹਾਂ ਕਿ ਵਹਿਮ ਭਰਮ ਦਾ ਇਲਾਜ ਕੋਈ ਦੁਨੀਆਂ ਦਾ ਡਾਕਟਰ ਨਹੀਂ ਕਰ ਸਕਦਾ ਨਾ ਹੀ ਕੋਈ ਵੈਦ ਕਰ ਸਕਦਾ